ਵੈਸੇ ਤਾਂ ਮੇਰੇ ਮਨਪਸੰਦੀ ਭੋਜਨ ਬਹੁਤ ਤਰ੍ਹਾਂ ਦੇ ਹਨ ਜਿਵੇਂ ਕਿ ਕੜੀ ਚੌਲ ਰਾਜਮਾਂਹ ਚੌਲ ਮੱਕੀ ਦੀ ਰੋਟੀ ਮੈਨੂੰ ਮੱਕੀ ਦੀ ਰੋਟੀ ਬਹੁਤ ਵਧੀਆ ਲੱਗਦੀ ਹੈ ਅਤੇ ਮੈਂ ਸਾਗ ਵੀ ਬਹੁਤ ਪਸੰਦ ਹੈ ਮੈਨੂੰ ਸਾਗ ਘਰ ਦਾ ਵਧੀਆ ਲੱਗਦਾ ਹੈ ਜੋ ਕਿ ਚੁੱਲ੍ਹੇ 'ਤੇ ਬਣਾਇਆ ਹੋਵੇ ਪਹਿਲਾਂ ਇਹਨੂੰ ਸਾਫ ਪਾਣੀ ਵਿੱਚ ਧੋ ਕੇ ਅਤੇ ਇਹ ਇਹਦੀਆਂ ਗੰਦਲਾਂ ਛਿੱਲ ਕੇ ਫਿਰ ਇ ਇਸਦੀ ਕਟਿੰਗ ਹੁੰਦੀ ਹੈ ਅਤੇ ਇਸ ਨੂੰ ਇਸ ਨੂੰ ਪਾ ਪਾਣੀ ਵਿੱਚ ਉਬਾਲ ਕੇ ਇਸ ਵਿੱਚ ਲੂਣ ਪਾ ਕੇ ਉਬਾਲ਼ਾ ਦਿੱਤਾ ਜਾਂਦਾ ਹੈ ਦੋ ਤਿੰਨ ਘੰਟੇ ਅਤੇ ਉਸ ਤੋਂ ਬਾਅਦ ਇਸ ਵਿੱਚ ਕੁੱਟ ਕੇ ਅਦਰਕ ਹਰੀਆਂ ਮਿਰਚਾਂ ਅਤੇ ਹੋਰ ਹੋਰ ਤਰ੍ਹਾਂ ਦੀਆਂ ਹੋਰ ਤਰ੍ਹਾਂ ਦੀਆਂ ਚੀਜ਼ਾਂ ਵੀ ਪਾਈਆਂ ਜਾਂਦੀਆਂ ਹਨ ਅਤੇ ਇਸ ਨੂੰ ਬਣਨ ਵਿੱਚ ਕਾਫੀ ਟਾਈਮ ਲੱਗ ਜਾਂਦਾ ਹੈ ਅਤੇ ਇਹ ਬਹੁਤ ਵਧੀਆ ਲੱਗਦਾ ਹੈ ਇਹ ਮੈਨੂੰ ਆਪਣੇ ਪਰਿਵਾਰ ਵਿੱਚ ਬੈਠ ਕੇ ਖਾਣਾ ਪਸੰਦ ਹੈ ਅਤੇ ਮੈਨੂੰ ਮੱਕੀ ਦੀ ਰੋਟੀ ਵੀ ਸਾਗ ਨਾਲ਼ ਖਾਣਾ ਬਹੁਤ ਪਸੰਦ ਹੈ ਅਤੇ ਇਸ ਉੱਤੇ ਦੇਸੀ ਘਿਓ ਲਾ ਕੇ ਬਹੁਤ ਵਧੀਆ ਲੱਗਦਾ ਹੈ ਇਸ ਨਾਲ਼ ਮੈਨੂੰ ਲੱਸੀ ਪੀਣਾ ਵੀ ਪਸੰਦ ਹੈ